ਹਾਂਜੀ ਮੇਰੇ ਕੋਲ ਇੱਕ ਮਨਪਸੰਦ ਕਿਤਾਬ ਹੈਗੀ ਹੈ ਜਿਹੜੀ ਮੈਨੂੰ ਤਾਂ ਕਲਾਸਿਕ ਲੱਗਦੀ ਹੈ ਪਤਾ ਨਹੀਂ ਹੁਣ ਹੋਵੇਗੀ ਕਿ ਨਹੀਂ ਬਾਕੀਆਂ ਦੇ ਹਿਸਾਬ ਨਾਲ ਉਹਦਾ ਨਾਮ ਹੈਗਾ ਅਲਕੇਮਿਸਟ ਅਤੇ ਪੰਜਾਬੀ 'ਚ ਉਹਦਾ ਨਾਮ ਹੈਗਾ ਸੁਪਨਸਾਜ਼ ਉਹ ਮੇਰੇ ਇੱਕ ਨਾਲ਼ ਦੇ ਪ੍ਰੋਫੈਸਰ ਸਾਹਿਬ ਤੋਂ ਲਿੱਤੀ ਸੀ ਮੈਂ ਤਾਂ ਉਹਨਾਂ ਤੋਂ ਲੈ ਕੇ ਮੈਂ ਜਦੋਂ ਪੜ੍ਹੀ ਥੋੜ੍ਹੀ ਜਿਹੀ ਤਾਂ ਮੈਨੂੰ ਉਹ ਬਹੁਤ ਵਧੀਆ ਲੱਗੀ ਜਿਹਦੇ ਕਰਕੇ ਮੈਂ ਉਹਨਾਂ ਦੀ ਕਿਤਾਬ ਤਾਂ ਪੂਰੀ ਆਪ ਤਾਂ ਉਹਨਾਂ ਤੋਂ ਲੈ ਕੇ ਪੂਰੀ ਪੜ੍ਹ ਨਹੀਂ ਸਕਿਆ ਸਮਾਂ ਘੱਟ ਸੀ ਤਾਂ ਮੈਂ ਉਹਨਾਂ ਦੀ ਕਿਤਾਬ ਵਾਪਸ ਕਰਤੀ ਤਾਂ ਫਿਰ ਉਹ ਕਿਤਾਬ ਮੈਂ ਖੁਦ ਜਾ ਕੇ ਆਪਣਾ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਤਾਬਾਂ ਦਾ ਮੇਲਾ ਲੱਗਿਆ ਤਾਂ ਉੱਥੋਂ ਖਰੀਦੀ ਅਤੇ ਉਹ ਕਿਤਾਬ ਖਰੀਦੀ ਫਿਰ ਮੈਂ ਉਹ ਪੜ੍ਹੀ ਅਤੇ ਮੈਨੂੰ ਬਹੁਤ ਆਨੰਦ ਆਇਆ ਅਤੇ ਮੈਂ ਬਾਕੀਆਂ ਨੂੰ ਵੀ ਪੜ੍ਹਾਈ ਤੇ ਇਹੀ ਸੀਗੀ ਕਿ ਵੀ ਮੈਂ ਉਹ ਪੜ੍ਹਨ ਦੇ ਨਾਲ ਮੈਨੂੰ ਜੋ ਸਮਝ ਲੱਗੀ ਠੀਕ ਹੈ ਉਹਨੇ ਮੈਨੂੰ ਬਹੁਤ ਮੇਰਾ ਜਿਹੜਾ ਮਾਇੰਡ ਆ ਡਿਵੈਲਪ ਕੀਤਾ ਠੀਕ ਹੈ ਤਾਂ ਇਸ ਕਰਕੇ ਵੀ ਉਹ ਮੈਨੂੰ ਲੱਗਦੀ ਹੈ ਕਲਾਸਿਕ ਵੀ ਲੱਗਦੀ ਹੈ ਅਤੇ ਮੇਰੀ ਮਨ ਦੇ ਬਹੁਤ ਨੇੜੇ ਵੀ ਹੈ